ਹੈਲੋ ਹਾਂਜੀ ਭੈਣ ਜੀ ਅੱਜ ਕਿਉਂ ਯਾਦ ਕੀਤਾ ਅੱਛਾ ਜੀ ਬੱਚੇ ਠੀਕ ਹੈ ਪੜ੍ਹਾਈ ਠੀਕ ਚੱਲ ਰਹੀ ਆ ਹਾਂਜੀ ਹਾਂਜੀ ਬਹੁਤ ਵਧੀਆ ਅੱਛਾ ਭਾਈ ਸਾਹਿਬ ਉਹਨਾਂ ਦਾ ਕੀ ਹਾਲ ਹੈ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਅੱਛਾ ਜੀ ਅੱਛਾ ਜੀ ਪਰ ਭੈਣ ਜੀ ਮੈਂ ਤਾਂ ਸੁਣਿਆ ਕਿ ਅੱਜਕੱਲ੍ਹ ਸਰਕਾਰੀ ਸਕੂਲਾਂ ਦੇ ਵਿੱਚ ਵੀ ਸਾਰੇ ਸਬਜੈਕਟ ਇੰਗਲਿਸ਼ ਵਿੱਚ ਵੀ ਪੜ੍ਹਾਈ ਜਾਂਦੇ ਆ ਹਾਂਜੀ ਕਿਉਂਕਿ ਸਰਕਾਰ ਦਾ ਵੀ ਕਾਫੀ ਜ਼ੋਰ ਲੱਗਾ ਹੋਇਆ ਕਿ ਇਹ ਸਕੂਲਾਂ ਨੂੰ ਵਧੀਆ ਬਣਾਉਣ ਦੇ ਲਈ ਕਾਫੀ ਖਬਰਾਂ ਵੀ ਆਉਂਦੀਆਂ ਆ ਅਤੇ ਮੇਰੇ ਬੱਚੇ ਵੀ ਜਾਂਦੇ ਹਾਂਜੀ ਅਤੇ ਹਾਂਜੀ ਠੀਕ ਹੈ ਜੀ ਮਤਲਬ ਕਿ ਸ਼ਹਿਰੀ ਬੱਚਿਆਂ ਦੇ ਮੁਕਾਬਲੇ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਲੈ ਜਾਣਾ ਚਾਹੁੰਦੇ ਆ ਨਾ ਅੱਛਾ ਜੀ ਆਪਣੇ ਨਜ਼ਦੀਕ ਭਲਾ ਕੋਈ ਸੀ ਬੀ ਐਸ ਸੀ ਸਕੂਲ ਹੈਗਾ ਅੱਛਾ ਜੀ ਨਵਾਂ ਖੋਲ੍ਹਿਆ ਅੱਛਾ ਜੀ ਪਰ ਸੀ ਬੀ ਐਸ ਸੀ ਤੁਸੀਂ ਸੀ ਬੀ ਐਸ ਸੀ ਕਹਿ ਰਹੇ ਸੀਗੇ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂ ਉਹ ਫਿਰ ਜਾ ਕੇ ਦੇਖਣਾ ਪੈਣਾ ਉਹਨਾਂ ਸਾਰਿਆਂ ਦਾ ਨਾ ਵੀ ਪੜ੍ਹਾਈ ਦਾ ਪੱਧਰ ਕੀ ਆ ਅਤੇ ਫੀਸਾਂ ਫੂਸਾਂ ਦਾ ਵੀ ਸਾਰਾ ਦੇਖਣਾ ਪੈਣਾ ਭੈਣ ਜੀ ਹਾਂ ਹਾਂਜੀ ਇਹ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਹਾਂ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਇੱਦਾਂ ਵੀ ਚਲੋ ਮੈਂ ਆਪਣੇ ਮੈਂ ਵੀ ਸੋਚਾਂਗੀ ਇੱਕ ਜ਼ਰੂਰ

ਅੱਛਾ ਜੀ ਹਾਂਜੀ ਅਤੇ ਨਾਲ ਸਿਲੇਬਸ ਦਾ ਵੀ ਕਹਿੰਦੇ ਬਹੁਤ ਫਰਕ ਆ ਨਾ ਸ਼ਾਇਦ ਬੱਚਿਆਂ 'ਤੇ ਟੈਂਸ਼ਨ ਘੱਟ ਆ ਨਾ ਹਾਂ ਹਾਂ ਨਹੀਂ ਇਹ ਤਾਂ ਤੁਸੀਂ ਬਿਲਕੁਲ ਸਹੀ ਸੋਚਿਆ ਭੈਣ ਜੀ ਅੱਛਾ ਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਤੁਸੀਂ ਜਦੋਂ ਜਾਓਗੇ ਤਾਂ ਮੈਨੂੰ ਜ਼ਰੂਰ ਨਾਲ ਲੈ ਕੇ ਜਾਣਾ ਅਤੇ ਮੈਂ ਵੀ ਦੇਖਾਂਗੀ ਆਪਣੇ ਬੇਟੇ ਨੂੰ ਮੈਂ ਵੀ ਫਿਰ ਉੱਥੇ ਹੀ ਪਾ ਦਵਾਂਗੀ ਹੈ ਨਾ ਜਿਵੇਂ ਤੁਸੀਂ ਠੀਕ ਸਮਝੋ ਫਿਰ ਆਪਾਂ ਉਦਾਂ ਹੀ ਕਰ ਲਵਾਂਗੇ ਕਿਉਂਕਿ ਮੇਨ ਆ ਕਿ ਬੱਚਿਆਂ ਦੀ ਜ਼ਿੰਦਗੀ ਬਣਾਉਣਾ ਸਾਡਾ ਫਰਜ਼ ਹੈ ਕੋਈ ਨਹੀਂ ਜੇ ਤੁਹਾਨੂੰ ਸਹੀ ਲੱਗਦਾ ਤਾਂ ਫਿਰ ਮੈਂ ਵੀ ਜ਼ਰੂਰ ਨਾਲ ਜਾ ਕੇ ਦੇਖਾਂਗੀ ਅਤੇ ਫਿਰ ਜਿਵੇਂ ਵੀ ਤੁਸੀਂ ਮੈਨੂੰ ਦੱਸ ਦਿਓ ਕਿ ਤੁਸੀਂ ਕਦੋਂ ਜਾ ਰਹੇ ਹੋ ਹੈ ਨਾ ਆਪਾਂ ਬੱਚਿਆਂ ਲਈ ਜ਼ਰੂਰ ਸੋਚਾਂਗੇ ਹਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ